ਹੈਲੋ ਮੇਰਾ ਨਾਂ ਜਗਪ੍ਰੀਤ ਸਿੰਘ ਹੈ ਕੀ ਤੁਸੀਂ ਸੰਧੂ ਟਰਾਂਸਪੋਰਟ ਤੋਂ ਗੱਲ ਕਰ ਰਹੇ ਹੋ ਮੈਂ ਅੱਜ ਤੋਂ ਪੰਜ ਦਿਨ ਪਹਿਲਾਂ ਇੱਕ ਕੈਬ ਬੁੱਕ ਕਰੀ ਸੀਗੀ ਜਿੱਥੇ ਕਿ ਅਸੀਂ ਸਾਰੀ ਫੈਮਿਲੀ ਨੇ ਘੁੰਮਣ ਜਾਣਾ ਸੀਗਾ ਜਿਹੜਾ ਕਿ ਤੁਹਾਡਾ ਡਰਾਇਵਰ ਸੀ ਉਹ ਸਾਡੇ ਨਾਲ ਉਹਨੇ ਫੈਮਲੀ ਤੌਰ 'ਤੇ ਵਿਹਾਰ ਕੀਤਾ ਅਤੇ ਉਹ ਡਰਾਇਵਰ ਸਾਨੂੰ ਬਹੁਤ ਹੀ ਚੰਗਾ ਲੱਗਿਆ ਉਸ ਨੇ ਗੱਡੀ ਦੀ ਬਹੁਤ ਹੀ ਜ਼ਿਆਦਾ ਸਫ਼ਾਈ ਰੱਖਦਾ ਸੀਗਾ ਤੇ ਅਤੇ ਨਾਲ ਦੇ ਨਾਲ ਹੀ ਕੋਵਿਡ ਹੋਣ ਦੇ ਨਾਲ ਉਸ ਨੇ ਆਪਣੀ ਗੱਡੀ ਵਿੱਚ ਸੈਨੀਟੇਜਰ ਵੀ ਰੱਖਿਆ ਹੋਇਆ ਸੀ ਅਤੇ ਮਾਕਸ ਵੀ ਲਗਾਇਆ ਹੋਇਆ ਸੀਗਾ ਅਤੇ ਉਸ ਨੇ ਸਾਡੇ ਨਾਲ ਫੈਮਿਲੀ ਤੌਰ 'ਤੇ ਰਹਿਣਾ ਰਹਿਣਾ ਸਹਿਣਾ ਕੀਤਾ ਅਤੇ ਅਸੀਂ ਉੱਥੇ ਪਹਿਲੀ ਵਾਰ ਹੀ ਗਏ ਸੀ ਟਰਿਪ 'ਤੇ ਨਵੀਂ ਥਾਂ ਸੀਗੀ ਸਾਨੂੰ ਉਹ ਡਰਾਈਵਰ ਬਹੁਤ ਹੀ ਵਧੀਆ ਲੱਗਿਆ ਅਤੇ ਤੁਹਾਡੀ ਗੱਡੀ ਦੀ ਬਹੁਤ ਹੀ ਜ਼ਿਆਦਾ ਸਫ਼ਾਈ ਸੀਗੀ ਜਿਵੇਂ ਕਿ ਸੀਟਾਂ ਸੂਟਾਂ ਸਾਰੀਆਂ ਨਵੀਆਂ ਸਨ ਗੱਡੀ ਦੀਆਂ ਅਤੇ ਗੱਡੀ ਬਾਹਰੋਂ ਵੀ ਬਹੁਤ ਹੀ ਸਾਫ਼ ਸੀ ਅਤੇ ਅੰਦਰੋਂ ਵੀ ਬਹੁਤ ਹੀ ਸਾਫ਼ ਸੀ ਅਤੇ ਮੈਂ ਤੁਹਾਡੀ ਸੰਧੂ ਟਾਂਸਪੋਰਟ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਤੁਹਾਡੇ ਡਰਾਇਵਰ ਵੀਰ ਦਾ ਵੀ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਮੈ ਸਾਨੂੰ ਤੁਹਾਡੀ ਗੱਡੀ ਦਾ ਅਤੇ ਕੈਬ ਬਹੁਤ ਹੀ ਜ਼ਿਆਦਾ ਪਸੰਦ ਆਈ ਅਤੇ ਅੱਗੇ ਤੋਂ ਵੀ ਅਸੀਂ ਤੁਹਾਨੂੰ ਹੀ ਕਿਤੇ ਜਾਣ ਆਉਣ ਲਈ ਤੁਹਾਨੂੰ ਹੀ ਕਹਾਂਗੇ ਅਤੇ ਇਸ ਲਈ ਅਸੀਂ ਸਾਰੀ ਫੈਮਿਲੀ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ